ਬਿਮਾਰੀਆਂ ਤੋਂ ਬਚਣ ਦੇ ਲਈ ਅੱਜ ਦੇ ਆਧੁਨਿਕ ਯੁੱਗ ਦੇ ਅੰਦਰ ਸੈਰ ਅਤੇ ਯੋਗਾ ਬਹੁਤ ਹੀ ਮਹੱਤਵਪੂਰਨ ਹਨ ਅਤੇ ਸਿਹਤਮੰਦ ਰਹਿਣ ਦੇ ਲਈ ਜਿਹੜੇ ਕੁੱਝ ਆਮ ਨੁਕਤੇ ਨੇ ਅੱਜ ਕੱਲ੍ਹ ਜੋ ਬਜ਼ਾਰਾਂ ਦੇ ਵਿੱਚ ਫੂਡ ਆ ਰਹੇ ਨੇ ਉਨ੍ਹਾਂ ਨੂੰ ਨਾ ਵਰਤਦੇ ਆਪਣੇ ਆਪ ਆਪਣੇੇ ਘਰੇ ਹੀ ਸਬਜ਼ੀਆਂ ਦਾਲਾਂ ਜਾਂ ਹੋਰ ਵਧੀਆ ਅਨਾਜ ਪਦਾਰਥ ਉਗਾਏ ਜਾਣ ਉਹੀ ਬਿਹਤਰ ਹਨ